ਹੈਲੋ ਹਾਂ ਮੈਂ ਨਾ ਤੁਹਾਡੇ ਨਾਲ ਇੱਥੇ ਟੂਰਿਸਟ 'ਤੇ ਆ ਰਿਹਾਂ ਵਾਂ ਮੈਂ ਇੱਥੇ ਘੁੰਮਣ ਲਈ ਆ ਰਿਹਾ ਤਰਨ ਤਾਰਨ ਬੰਗਲੌਰ ਤੋਂ ਆ ਰਿਹਾ ਬਾਏ ਟ੍ਰੇਨ ਬਾਏ ਟ੍ਰੇਨ ਆ ਰਿਹਾਂ ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਮੈਂ ਜਾਣਾ ਵਾਪਸ ਬਾਈ ਏਅਰ ਆ ਅਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੇ ਇੱਥੇ ਲਾਗੇ ਕੋਈ ਏਅਰਪੋਰਟ ਵਧੀਆ ਏਅਰਪੋਰਟ ਪੈਂਦਾ ਜਿਹਦੀ ਯਾਨੀ ਕਿ ਸੇਵਾ ਜਿਹੜੀ ਆ ਉਹ ਵਧੀਆ ਹੋਵੇ ਹਾਂਜੀ

ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਆਪਾਂ ਦੂਰ ਉਹ ਆਪਾਂ ਨੂੰ ਦੂਰ ਪਉ ਥੋੜ੍ਹਾ ਜਿਹਾ ਅੱਛਾ ਜੀ ਅਤੇ ਹੋਰ ਹਾਂਜੀ ਉਹ ਬਠਿੰਡੇ ਨੇ ਬਠਿੰਡੇ ਨਾਲੋਂ ਕਿਹੜਾ ਨੇੜੇ ਪਊਗਾ ਜੀ ਇਹਨਾਂ ਤਿੰਨਾਂ 'ਚੋਂ ਅੱਛਾ ਜੀ ਅੱਛਾ ਚਲੋ ਠੀਕ ਹੈ ਚਲੋ ਠੀਕ ਹੈ ਜੀ ਓਕ